ਦੋ ਜੁਲਾਈ ਉੱਨੀ ਸੌ ਨੱਬੇ ਇਕ ਅਗਸਤ ਉੱਨੀ ਸੌ ਪਚਾਨਵੇਂ ਵੀਹ ਸਤੰਬਰ ਦੋ ਹਜ਼ਾਰ ਪੰਜ ਨੌਂ ਅਕਤੂਬਰ ਦੋ ਹਜ਼ਾਰ ਪੰਦਰਾਂ ਅਠਾਰਾਂ ਦਸੰਬਰ ਦੋ ਹਜ਼ਾਰ ਵੀਹ